ਮੈਂ ਅਤੇ ਮੇਰੇ ਮਿੱਤਰ ਰਾਤ ਦੇ ਸਮੇਂ 'ਚ ਇੱਕ ਚੜ੍ਹਾਈ ਦੇ ਸਥਾਨ 'ਤੇ ਗਏ ਸੀਗੇ ਜਿੱਥੇ ਅਸੀਂ ਆਪਣਾ ਮਸਤੀ ਨਾਲ ਚੜ੍ਹਾਈ ਕਰ ਰਹੇ ਸੀ ਅਤੇ ਅਚਾਨਕ ਸਾਡੇ ਰਾਹ ਦੇ ਵਿੱਚ ਇੱਕ ਸਾਨੂੰ ਵਿਘਨ ਪੈ ਗਿਆ ਅਤੇ ਜੋ ਕਿ ਸਾਡੇ ਮੂਹਰੇ ਇੱਕ ਅਜੀਬ ਤਰ੍ਹਾਂ ਦਾ ਜਾਨਵਰ ਸੀ ਅਤੇ ਉਹ ਇੱਕ ਇੰਨਾ ਅਜੀਬ ਸੀਗਾ ਅਤੇ ਅਸੀਂ ਉਹਨੂੰ ਦੇਖ ਕੇ ਡਰ ਗਏ ਅਤੇ ਓ ਅਸੀਂ ਆਪਣੇ ਰਾਹ ਤੋਂ ਕੁਛ ਭਟਕ ਗਏ ਅਤੇ ਉਹ ਤੋਂ ਸਾਨੂੰ ਸਿੱਖਣ 'ਚ ਇਹ ਮਿਲਿਆ ਕਿ ਕਦੇ ਵੀ ਕੁਛ ਇੱਦਾਂ ਦਾ ਕੋਈ ਕੰਮ ਕਰਨਾ ਹੈ ਖਤਰੇ ਵਾਲਾ ਤਾਂ ਉਹਨੂੰ ਦਿਨ 'ਚ ਜਾਂ ਵੱਡਿਆਂ ਦੀ ਮੌਜੂਦਗੀ 'ਚ ਕਰਨਾ ਚਾਹੀਦਾ ਹੈ